ਸਾਨੂੰ ਸਾਡੇ ਖੇਤਰ ਵਿੱਚ ਸਲਾਈ ਕਢਾਈ ਦੇ ਬਹੁਤ ਸਾਰੇ ਪੈਟਰਨ ਆ ਜਿਹੜੇ ਉਹ ਪਤਾ ਹੈਗੇ ਆ ਜਿਵੇਂ ਪੇਂਟ ਕਰਨਾ ਸੂਟਾਂ ਨੂੰ ਅਤੇ ਉਹਨਾਂ ਨੂੰ ਸਿਲਾਈ ਵਰਕ ਦੇਣਾ ਕਢਾਈ ਕਰਨੀ ਹੱਥੀ ਕਢਾਈ ਕਰਨੀ ਕਢਾਈ ਦੇ ਅਲੱਗ ਅਲੱਗ ਨਾਮ ਆ ਜਿਵੇਂ ਬੁਟੀਕ ਦੀ ਹੋ ਜਾਂਦੀ ਹੈ ਮਸ਼ੀਨੀ ਕਢਾਈ ਹੋ ਜਾਂਦੀ ਹੈ ਹੱਥ ਦੀ ਕਢਾਈ ਹੋ ਜਾਂਦੀ ਹੈਗੀ ਪੁਰਾਣੇ ਸਮੇਂ ਵਿੱਚ ਮਸ਼ੀਨੀ ਵਰਕ ਨਹੀਂ ਸੀਗਾ ਲੋਕ ਹੱਥੀਂ ਕੱਢਿਆ ਹੀ ਕੱਪੜਾ ਪਾਉਂਦੇ ਸੀਗੇ ਪਰ ਇਹ ਦਿਨੋਂ ਦਿਨ ਜਿਹੜਾ ਰਿਵਾਜ਼ ਹੈ ਉਹ ਚੇਂਜ ਹੁੰਦਾ ਗਿਆ ਹੈ ਨਵੇਂ ਕੱਪੜੇ ਬਣਨੇ ਸ਼ੁਰੂ ਹੋ ਗਏ ਆ ਹੁਣ ਇੱਥੋਂ ਤੱਕ ਕਿ ਮੈਂ ਨਵੀਂ ਗੱਲ ਕਰਾਂ ਵੀ ਇੱਥੋਂ ਤੱਕ ਕਿ ਹੁਣ ਔਨਲਾਈਨ ਹੈ ਜਿਹੜਾ ਮਸ਼ੀਨਾਂ ਵੀ ਆ ਗਈਆਂ ਹੈਗੀਆਂ ਇੱਕ ਸੂਟ ਤੁਸੀਂ ਮਸ਼ੀਨ ਦੇ ਵਿੱਚ ਲਾਓ ਉਹਨੂੰ ਡਿਜ਼ਾਇਨ ਸਿਲੈਕਟ ਕਰਕੇ ਦਿਓ ਅਤੇ ਉਹ ਉਹ ਹੀ ਜਿਹਾ ਹੀ ਸੂਟ ਕੱਢ ਕੇ ਤੋ ਦੇ ਦਿੰਦੀ ਹੈਗੀ ਵੀ ਨਵੀਂ ਨਵੀਂ ਟੈਕਨੀਕ ਦਿਨੋਂ ਦਿਨ ਆ ਰਹੀ ਹੈ ਸਿਲਾਈ ਕਢਾਈ ਸਾਡੀ ਰਵਾਇਤੀ ਜ਼ਿੰਦਗੀ ਦਾ ਦੇਣ ਹੋ ਗਈ ਆ ਯਾਰ ਮੈਂ ਕਿਵੇਂ ਬੋਲਾਂ